ਆਪਾਂ ਜਿਹੜੇ ਧਾਰਮਿਕ ਤਿਉਹਾਰ ਬਣਾਉਣੇ ਆ ਵੀ ਸਾਲ 'ਚ ਜਿਹੜੇ ਆਪਾਂ ਨੂੰ ਆਉਂਦੇ ਆ ਦੀਵਾਲੀ ਅਤੇ ਗੁਰੂ ਨਾਨਕ ਮਹਾਰਾਜ ਦੇਵ ਜੀ ਦਾ ਜਨਮਦਿਨ ਤਿਉਹਾਰ ਅਤੇ ਲੋਹੜੀ ਬੜੇ ਖੁਸ਼ੀਆਂ ਚਾਵਾਂ ਦੇ ਨਾਲ ਮਨਾਉਂਦੇ ਹਾਂ ਆਪਾਂ ਸਾਰੇ ਪਰਿਵਾਰ ਦੇ ਨਾਲ ਰਲ ਕੇ ਮਨਾਉਂਦੇ ਹਾਂ ਇਹ ਦੀਵਾਲੀ ਦੇ ਵਿੱਚ ਬੜੀਆਂ ਬੜੀਆਂ ਸਫਾਈਆਂ ਕਰਦੇ ਹੈ ਘਰਾਂ ਨੂੰ ਸਜਾਉਂਦੇ ਹੈ ਮਹੀਨਾ ਪਹਿਲਾਂ ਲੱਗ ਜਾਣੇ ਹੈ ਸਾਫ ਸਫਾਈਆਂ ਕਰਨ ਤੇ ਸਜਾਉਣ ਅਤੇ ਦੀਵਾਲੀ ਦੇ ਤਿਉਹਾਰਾਂ ਦੇ ਵਿੱਚ ਫੇਰ ਕੁੜੀਆਂ ਕੋਲ ਜਾਈਦਾ ਮਠਿਆਈਆਂ ਲੈ ਕੇ ਫਲ ਫਰੂਟ ਲੈ ਕੇ ਜਾਈਦਾ ਅਤੇ ਖੋਏ ਕੱਢਦੇ ਹੈ ਘਰ ਖੋਏ ਲੈ ਕੇ ਜਾਈਦਾ ਮਠਿਆਈ ਲੈ ਕੇ ਜਾਈਦਾ ਅਤੇ ਕੁੜੀਆਂ ਨੂੰ ਵਿਚਾਰੀਆਂ ਨੂੰ ਜਾ ਕੇ ਸਹੁਰੀ ਇਹ ਤਿਉਹਾਰ ਮਨਾ ਕੇ ਆਉਣੇ ਹੈ ਦੇ ਕੇ ਆਉਣੇ ਹੈ ਅਤੇ ਉਦੋਂ ਵੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਦਿਨ ਆਉਂਦਾ ਹੈ ਉਹ ਮਨਾਉਂਦੇ ਹਾਂ ਅਤੇ ਫਿਰ ਲੋਹੜੀ ਆਉਂਦੀ ਹੈ ਲੋਹੜੀ ਆਉਂਦੀ ਹੈ ਲੋਹੜੀ ਦਾ ਤਿਉਹਾਰ ਮਨਾਉਂਦੇ ਹਾਂ ਮਾਘੀ ਆਉਂਦੀ ਹੈ ਅਤੇ ਕੁਛ ਕੁਛ ਧਾਰਮਿਕ ਥਾਵਾਂ ਦੇ ਉੱਤੇ ਇਸ਼ਨਾਨ ਕਰਨ ਜਾਂਦੇ ਹੈ ਦੁਨੀਆਂ 'ਤੇ ਇਸ਼ਨਾਨ ਕਰਕੇ ਆਉਂਦੇ ਹੈ ਅਤੇ ਬੜੇ ਚਾਵਾਂ ਦੇ ਨਾਲ ਇਹ ਤਿਉਹਾਰ ਮਨਾਈ ਦੇ ਹੈ ਬੜੀਆਂ ਖੁਸ਼ੀਆਂ ਦੇ ਨਾਲ ਮਨਾਈ ਦੇ ਹੈ ਅਤੇ ਦੀਵਾਲੀ ਆਲੇ ਦਿਨਾਂ ਦੇ ਵਿੱਚ ਘਰਾਂ ਦੀਆਂ ਸਫਾਈਆਂ ਹੁੰਦੀਆਂ ਲੱਛਮੀ ਮਾਤਾ ਆਵੇਗੀ ਅਤੇ ਜੋ ਵੀ ਖਾਣ ਪਕਾਉਣ ਘਰ ਦੇ ਵਿੱਚ ਕਰੀ ਦੇ ਹੈ ਬੜੀ ਖੁਸ਼ੀਆਂ ਅਤੇ ਚਾਵਾਂ ਦੇ ਨਾਲ ਮਨਾਈ ਦੇ ਹੈ ਕਰੀ ਦੇ ਹੈ ਆਥਣੇ ਬੱਚੇ ਪਟਾਕੇ ਚਲਾਉਂਦੇ ਆ ਬੜੀਆਂ ਖੁਸ਼ੀਆਂ ਮਨਾਉਂਦੇ ਹੈ ਅਤੇ ਇਹ ਦਿਨ ਪਰਮਾਤਮਾ ਆਖੀਦਾ ਵੀ ਸਭ 'ਤੇ ਖੁਸ਼ੀਆਂ ਭਰੇ ਹੋਣ ਅਤੇ ਬੜੇ ਖੁਸ਼ੀਆਂ ਖੁਸ਼ੀਆਂ ਦੇ ਵਿੱਚ ਸਾਲ ਮਹੀਨੇ ਪ੍ਰਵਾਨ ਕਰੀਦੇ ਨੇ